ਮੈਂ ਕਈ ਕਿਸਮ ਦੇ ਪੌਦੇ ਅਤੇ ਵੇਲ ਵੇਲਾਂ ਉਗਾਉਂਦਾ ਹਾਂ ਪੌਦਿਆਂ ਦੇ ਵਿੱਚ ਹੋ ਗਏ ਜਿਵੇਂ ਕਿ ਮਿਰਚਾਂ ਦੇ ਪੌਦੇ ਹੋ ਗਏ ਸ਼ਿਮਲਾ ਮਿਰਚ ਦੇ ਪੌਦੇ ਹੋ ਗਏ ਭਿੰਡੀਆਂ ਦੇ ਪੌਦੇ ਹੋ ਗਏ ਉਸਦੇ ਨਾਲ਼ ਨਾਲ਼ ਆਪਣਾ ਬੈਂਗਣ ਦੇ ਪੌਦੇ ਹੋ ਗਏ ਉਗਾਉਂਦਾ ਹਾਂ ਵੇਲਾਂ ਦੇ ਵਿੱਚ ਦੇਖਿਆ ਜਾਵੇ ਵੇਲਾਂ ਦੇ ਵਿੱਚ ਮੈਂ ਟਿੰਡੇ ਦੀ ਵੇਲਾਂ ਤੋਰੀ ਕੱਦੂ ਘੀਆ ਹੋ ਗਿਆ ਘੀਆ ਹੋ ਗਈ ਉਸ ਦੇ ਨਾਲ਼ ਨਾਲ਼ ਖੀਰਿਆਂ ਦੀਆਂ ਵੇਲਾਂ ਵੀ ਉਗਾਉਂਦਾ ਹਾਂ